ਪਹਿਲਾਂ ਤਾਂ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮੈਨੂੰ ਦੋ ਲੱਖ ਦਾ ਲੋਨ ਇੱਕ ਪ੍ਰਾਈਵੇਟ ਬੈਂਕ ਤੋਂ ਲੈਣਾ ਪਿਆ ਉਸ ਤੋਂ ਬਾਅਦ ਮੈਂ ਆਪਣਾ ਇੱਕ ਛੋਟਾ ਜਿਹਾ ਕਾਰੋਬਾਰ ਸਟਾਰਟ ਕੀਤਾ ਜਿਹਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਕਿ ਕੁਰਸੀ ਮੇਜ ਟੇਬਲਫੈਨ ਸੋਫੇ ਛੋਟੀਆਂ ਛੋਟੀਆਂ ਪਲਾਸਟਿਕ ਦੀਆਂ ਚੀਜ਼ਾਂ ਪੱਖੇ ਵਿੰਡੋਫੈਨ ਇਹ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਕਿ ਆਸਾਨ ਕਿਸ਼ਤਾਂ 'ਤੇ ਲੋਕਾਂ ਨੂੰ ਦੇਣ ਦਾ ਕੰਮ ਸਟਾਰਟ ਕੀਤਾ ਉਹਦੇ ਵਿੱਚ ਲੋਕ ਕਈ ਪਰਸਨ ਇਹੋ ਜਿਹੇ ਸਨ ਕਿ ਲੋਕ ਮੈਨੂੰ ਕਈ ਕਿਸ਼ਤਾਂ ਪ੍ਰੋਪਰ ਦੇ ਜਾਣ ਸਨ ਉਸ ਤੋਂ ਬਾਅਦ ਕੁਝ ਪਰਸਨ ਮੈਨੂੰ ਈਰੀਟੇਟ ਕਰਦੇ ਸਨ ਮੈਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਿਵੇਂ ਕਿ ਲੋਕ ਮੇਰੇ ਤੋਂ ਆਸਾਨ ਕਿਸਤਾਂ 'ਤੇ ਸਮਾਨ ਲੈ ਜਾਂਦੇ ਸਨ ਮੈਨੂੰ ਦੋ ਤਿੰਨ ਕਿਸਤਾਂ ਦੇ ਕੇ ਉਸ ਤੋਂ ਬਾਅਦ ਮੈਨੂੰ ਉਹਨਾਂ ਦੇ ਘਰ ਜਾਣਾ ਪੈਂਦਾ ਸੀ ਕਿਸ਼ਤਾਂ ਵਾਸਤੇ ਉਹਨਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਸੀਗੀਆਂ ਵੀ ਮੈਨੂੰ ਤੁਸੀਂ ਕਿਸ਼ਤਾਂ ਦੇ ਜਾਓ ਉਹ ਮੈਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਜੋ